ਹੈਲੋ ਕੀ ਤੁਸੀਂ ਕੁਲਵਿੰਦਰ ਸਰ ਬੋਲ ਰਹੇ ਹੋ ਹਾਂਜੀ ਸਰ ਮੈਨੂੰ ਤੁਹਾਡਾ ਨੰਬਰ ਰੀਡ ਐਪ ਤੋਂ ਮਿਲਿਆ ਹਾਂਜੀ ਸਰ ਸਰ ਮੈਨੇ ਨਾ ਮਤਲਬ ਸਾਡੀ ਫੈਮਿਲੀ ਨੇ ਸੱਤ ਦਿਨਾਂ ਦਾ ਟੂਰ ਬੁੱਕ ਕਰਨਾ ਸੀ ਹਾਂਜੀ ਅਸੀਂ ਸਾਰਾ ਪੰਜਾਬ ਘੁੰਮਣਾ ਕੀ ਤੁਸੀਂ ਇੱਕ ਡਰਾਈਵਰ ਅਤੇ ਇੱਕ ਆਪਣੀ ਇੱਕ ਗੱਡੀ ਦੇ ਸਕਦੇ ਹੋ ਸੱਤ ਦਿਨਾਂ ਦੇ ਟੂਰ ਲਈ ਹਾਂਜੀ ਸਰ ਅਸੀਂ ਨਾ ਸਾਰੇ ਪੰਜਾਬ ਦੇ ਮੇਨ ਮੇਨ ਜਿਹੜੇ ਵੀ ਪ੍ਰਸਿੱਧ ਸਥਾਨ ਹਨ ਉੱਥੇ ਉਹਨਾਂ ਦਾ ਟੂਰ ਕਰਨਾ ਹਾਂਜੀ ਸਰ ਸਾਨੂੰ ਅਸੀਂ ਤੁਹਾਡੀ ਗੱਡੀ ਇਸ ਲਈ ਬੁੱਕ ਕਰ ਰਹੇ ਹਾਂ ਕਿ ਅਸੀਂ ਤੁਹਾਡੀ ਐਪ ਦਾ ਬਹੁਤ ਨਾਮ ਸੁਣਿਆ ਹੈ ਕਿ ਤੁਹਾਡੀ ਸਰਵਿਸ ਬਹੁਤ ਚੰਗੀ ਹੈ ਜੋ ਤੁਸੀਂ ਡਰਾਈਵਰ ਭੇਜਦੇ ਹੋ ਉਹ ਵੀ ਬਹੁਤ ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਹੈ ਅਸੀਂ ਸੱਤ ਦਿਨਾਂ ਦਾ ਟੂਰ ਬੁੱਕ ਕੀਤਾ ਸੀ ਹਾਂਜੀ ਸਰ ਤੁਹਾਡਾ ਡਰਾਈਵਰ ਬਹੁਤ ਚੰਗਾ ਹੈ ਉਸਨੇ ਸਾਨੂੰ ਸਾਰੇ ਸਥਾਨਾਂ 'ਤੇ ਚੰਗੀ ਤਰ੍ਹਾਂ ਦਿਖਾਇਆ ਜਿਹੜੇ ਸਥਾਨਾਂ ਦਾ ਸਾਨੂੰ ਨਹੀਂ ਪਤਾ ਸੀ ਉਸਨੇ ਸਾਨੂੰ ਉਹ ਚੰਗੀ ਤਰ੍ਹਾਂ ਦੱਸਿਆ ਕਿ ਇੱਥੇ ਇਸਦੀ ਇਸ ਖਾਸੀਅਤ ਹੈ ਇਹ ਇਸ ਕਰਕੇ ਮਸ਼ਹੂਰ ਹੈ ਉਸ ਦਾ ਸੁਭਾਅ ਵੀ ਬਹੁਤ ਚੰਗਾ ਸੀ ਉਸ ਨੇ ਸਾਨੂੰ ਇੱਕ ਇੱਕ ਜਗ੍ਹਾ ਬਹੁਤ ਹੀ ਧਿਆਨ ਨਾਲ ਬਹੁਤ ਹੀ ਪਿਆਰ ਨਾਲ ਦਿਖਾਈ ਜਿਸ ਕਰਕੇ ਸਾਡਾ ਟੂਰ ਬਹੁਤ ਵਧੀਆ ਗਿਆ ਸਾਨੂੰ ਤੁਹਾਡੇ ਡਰਾਈਵਰ ਦੀ ਸਰਵਿਸ ਅਤੇ ਤੁਹਾਡੀ ਐਪ ਦੀ ਸਰਵਿਸ ਵੀ ਬਹੁਤ ਚੰਗੀ ਲੱਗੀ ਸਾਡੀ ਫੈਮਿਲੀ ਵੀ ਬਹੁਤ ਖੁਸ਼ ਹੋਈ ਤੁਹਾਡੇ ਡਰਾਈਵਰ ਤੋਂ ਕੀ ਤੁਹਾਡਾ ਡਰਾਈਵਰ ਦਾ ਸੁਭਾਅ ਬਹੁਤ ਹੀ ਚੰਗਾ ਹੈ ਅਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇੰਨੀ ਚੰਗੀ ਸਰਵਿਸ ਦਿੱਤੀ ਹਾਂਜੀ ਸਰ ਓਕੇ ਸਰ ਥੈਂਕ ਯੂ ਸਰ